ਅੱਜ ਕੱਲ੍ਹ ਮਤਲਬ ਕਿ ਹਰੇਕ ਹੀ ਘਰ ਵਿੱਚ ਆਪਾਂ ਖਾਣਾ ਬਣਾਉਂਦੇ ਹਾਂ ਸਾਨੂੰ ਖਾਣਾ ਬਣਾਉਣ ਸਮੇਂ ਬਹੁਤ ਹੀ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਆ ਜਦੋਂ ਵੀ ਆਪਾਂ ਖਾਣਾ ਬਣਾਉਂਦੇ ਹਾਂ ਤਾਂ ਆਪਾਂ ਨੂੰ ਮਤਲਬ ਕਿ ਇੱਕ ਪੂਰਾ ਸੀਰੀਅਸ ਹੋਣਾ ਚਾਹੀਦਾ ਆਪਣੇ ਖਾਣੇ ਨੂੰ ਲੈ ਕੇ ਮਤਲਬ ਕਿ ਉੱਥੇ ਆਪਾਂ ਅੱਗ 'ਤੇ ਖਾਣਾ ਬਣਾਉਂਦੇ ਹਾਂ ਜਿਹਦੇ ਨਾਲ ਮਤਲਬ ਕਿ ਕਈ ਵਰੀ ਆਪਾਂ ਨੂੰ ਜਦੋਂ ਆਪਾਂ ਅਨਕੋਨਸ਼ੀਅਸ ਹੁੰਦੇ ਹਾਂ ਤਾਂ ਆਪਾਂ ਨੂੰ ਆਪਣੀ ਕਈ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਜਿਵੇਂ ਕਿ ਬਲਾਸਟ ਹੋ ਜਾਂਦਾ ਹੈ ਜਿਵੇਂ ਕੁਝ ਵੀ ਹੋ ਜਿਵੇਂ ਕਿ ਕਿਸੇ ਦੇ ਉਪਰ ਡਿੱਗ ਜਾਂਦਾ ਹੈ ਖਾਣਾ ਬਣਾਉਣ ਸਮੇਂ ਆਪਾਂ ਨੂੰ ਸਭ ਤੋਂ ਪਹਿਲਾਂ ਕਿ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਉਪਰ ਛਿੱਟੇ ਪੈ ਸਕਦੇ ਆ ਮਤਲਬ ਤੜਕਾ ਪੈ ਸਕਦਾ ਹੈ ਕੁਝ ਵੀ ਪੈ ਸਕਦਾ ਹੈ ਆਪਣੇ ਆਪ ਨੂੰ ਵੀ ਥੋੜ੍ਹਾ ਪਿੱਛੇ ਰੱਖ ਕੇ ਥੋੜ੍ਹਾ ਦੂਰ ਰਹਿ ਕੇ ਬੋਲਨਾ ਬਣਾਉਣਾ ਚਾਹੀਦਾ ਹੈ ਖਾਣਾ ਜਦੋਂ ਆਪਾਂ ਖਾਣਾ ਬਣਾਉਂਦੇ ਹਾਂ ਅਤੇ ਆਪਾਂ ਨੂੰ ਆਪਾਂ ਨੂੰ ਮਤਲਬ ਕਿ ਲਾਗੇ ਬੰਨੇ ਦੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਕੁਝ ਵਿੱਚ ਨਾ ਡਿੱਗ ਜੇ ਜਾਂ ਕੁਝ ਵੀ ਨਾ ਹੋ ਜਾਵੇ ਹਮੇਸ਼ਾਂ ਆਪਾਂ ਨੂੰ ਖਾਣਾ ਬਣਾਉਣ ਦੇ ਟਾਈਮ ਆਪਣੇ ਆਪਣੇ ਮੋਬਾਇਲ ਫੋਨ ਜਾਂ ਫਿਰ ਆਪਣੇ ਸੈਲਫੋਨਸ ਨੂੰ ਵੀ ਦੂਰ ਰੱਖਣਾ ਚਾਹੀਦਾ ਹੈ ਆਪਣੇ ਆਪਣੇ ਖਾਣੇ ਵੱਲ ਕੌਨਸਨਟਰੇਟ ਕਰਨਾ ਚਾਹੀਦਾ ਹੈ ਜਿਹਦੇ ਨਾਲ ਮਤਲਬ ਕਿ ਉਹ ਵਧੀਆ ਵੀ ਬਣੇ ਅਤੇ ਆਪਣੋਂ ਮਤਲਬ ਕਿ ਅੱਗੇ ਜਾ ਕੇ ਜਿਹਦੇ ਨਾਲ ਅਗਰ ਕੁਝ ਵਿੱਚ ਪੈ ਜਾਵੇ ਆਪਾਂ ਨੂੰ ਆਪਾਂ ਜਿਵੇਂ ਗੱਲਾਂ ਕਰ ਰਹੇ ਹਾਂ ਠੀਕ ਹੈ ਮੈਂ ਗੱਲਾਂ ਕਰ ਰਹੀ ਹਾਂ ਮੈਂ ਆਪਣੇ ਖਾਣੇ ਵੱਲ ਨਹੀਂ ਧਿਆਨ ਦੇ ਰਹੀ ਅਤੇ ਮੇਰੇ ਖਾਣੇ ਵਿੱਚ ਕੁਝ ਡਿੱਗ ਜਾਂਦਾ ਹੈ ਜਿਹਦੇ ਨਾਲ ਮਤਲਬ ਕਿ ਮੇਰੀ ਵੀ ਹੈਲਥ ਪ੍ਰੋ ਮਤਲਬ ਕੋਨਸੀਅਸ ਹੋ ਜਾਂਦੀ ਹੈਲਥ ਬਿਮਾਰ ਹੋ ਜਾਂਦੀ ਹੈ ਮੇਰੇ ਘਰ ਦੇ ਵੀ ਬਿਮਾਰ ਹੋਜੁਗੇ ਅਤੇ ਅਗਾਂਹ ਜਾ ਕੇ ਮਤਲਬ ਕਿ ਸਾਨੂੰ ਕਾਫ਼ੀ ਸਾਰੀਆਂ ਚੀਜ਼ਾਂ ਨੂੰ ਫੇਸ ਕਰਨਾ ਪੈਂਦਾ ਬਿਮਾਰੀਆਂ ਨੂੰ ਫੇਸ ਕਰਨਾ ਪਊਗਾ ਇਸ ਲਈ ਮੈਂ ਜਦੋਂ ਵੀ ਖਾਣਾ ਬਣਾਉਂਦੀ ਹਾਂ ਤਾਂ ਮੈਂ ਹਮੇਸ਼ਾ ਆਪਣੇ ਖਾਣੇ ਵੱਲ ਧਿਆਨ ਦਿੰਦੀ ਹਾਂ ਉੱਥੇ ਖੜੀ ਰਹਿੰਦੀ ਹਾਂ ਕਿ ਮੇਰਾ ਖਾਣਾ ਵਧੀਆ ਤਰ੍ਹਾਂ ਪੱਕ ਗਿਆ ਹੈ ਪਕਾਉਣਾ ਚਾਹੀਦਾ ਆਪਣੇ ਖਾਣੇ ਨੂੰ ਵਧੀਆ ਤਰ੍ਹਾਂ ਮਤਲਬ ਲਾਗੇ ਬੰਨੇ ਮੈਂ ਕਿਸੇ ਨੂੰ ਵੀ ਨਹੀਂ ਆਉਣ ਦਿੰਦੀ ਨਾ ਆਪਣਾ ਸੈਲਫੋਨ ਜਾਂ ਕੁਝ ਵੀ ਆਪਣੇ ਹੱਥ ਵਿੱਚ ਨਹੀਂ ਲੈਂਦੀ ਕਿ ਮੇਰਾ ਧਿਆਨ ਸਿਰਫ਼ ਮੇਰੇ ਖਾਣੇ ਵੱਲ ਹੋਵੇ ਜਿਹਦੇ ਨਾਲ ਮਤਲਬ ਕਿ ਸਾਰਿਆਂ ਨੂੰ ਵਧੀਆਂ ਵੀ ਲੱਗੇ ਮੇਰਾ ਖਾਣਾ ਅਤੇ ਉਹ ਮਤਲਬ ਕਿ ਇੱਕ ਸਾਡੇ ਲਈ ਬੜਾ ਵਧੀਆ ਵੀ ਬਣ ਜਾਵੇ ਅਤੇ ਸਾਨੂੰ ਉਹਦੇ ਨਾਲ ਕੋਈ ਵੀ ਜ਼ਿਆਦਾ ਪ੍ਰੋਬਲਮ ਫੇਸ ਨਹੀਂ ਕਰਨੀ ਚਾਹੀਦੀ ਕਿਉਂਕਿ ਅੱਜ ਕੱਲ੍ਹ ਜਿਹੜੇ ਲੋਕ ਆ ਨਾ ਉਹਨਾਂ ਨੂੰ ਸਭ ਤੋਂ ਹੀ ਜ਼ਿਆਦਾ ਮੇਨ ਪ੍ਰੋਬਲਮ ਹੋ ਗਈ ਹੈ ਫੂਡ ਪੋਇਸਨਿੰਗ ਠੀਕ ਹੈ ਫੂਡ ਪੋਇਸਨਿੰਗ ਇੱਕ ਮਤਲਬ ਕਿ ਇਹੋ ਜਿਹੀ ਬਿਮਾਰੀ ਹੋ ਗਈ ਹੈ ਕਿ ਆਪਾਂ ਖਾਣਾ ਵਧੀਆਂ ਨਹੀਂ ਬਣਾ ਰਹੇ ਕੱਚਾ ਹੈ ਪੱਕਾ ਹੈ ਜਾਂ ਉਹਦੇ ਵਿੱਚ ਕੁਝ ਡਿੱਗ ਗਿਆ ਹੈ ਜਾਂ ਕੁਝ ਹੋ ਗਿਆ ਜਿਹਦੇ ਨਾਲ ਮਤਲਬ ਕਿ ਸਾਨੂੰ ਬੜੀ ਵੱਡੀ ਪ੍ਰੋਬਲਮ ਫੇਸ ਕਰਨਾ ਚਾਹੀਦਾ ਫੂਸ ਪੋ ਆਪਾਂ ਕਰਦੇ ਹਾਂ ਠੀਕ ਹੈ ਫੂਡ ਪੋਇਸਨਿੰਗ ਅਤੇ ਆਪਾਂ ਨੂੰ ਮਤਲਬ ਬਾਹਰ ਦੇ ਫੂਡ ਵੱਲ ਵੀ ਇੰਨਾ ਧਿਆਨ ਨਹੀਂ ਦੇਣਾ ਚਾਹੀਦਾ ਅਤੇ ਹਮੇਸ਼ਾਂ ਘਰ ਦਾ ਖਾਣਾ ਖਾਣਾ ਚਾਹੀਦਾ ਹੈ ਡੈਟਸ ਵਾਏ ਆਈ ਵੁੱਡ ਸੈੱਡ ਸਟੇ ਹੈਲਦੀ ਈਟ ਹੈਲਦੀ